ਸਾਨੂੰ ਭਾਰਤ ਦੇ ਹਰੇਕ ਰਾਜ ਵਿੱਚ ਜਾਣਾ ਚਾਹੀਦਾ ਹੈ ਕਿਉਂਕਿ ਭਾਰਤ ਦੇ ਅਲੱਗ ਅਲੱਗ ਰਾਜ ਵਿੱਚ ਸਾਨੂੰ ਅਲੱਗ ਅਲੱਗ ਤਰੀਕੇ ਦਾ ਕਲਚਰ ਧਾਰਮਿਕ ਸਥਾਨਾਂ ਅਤੇ ਉੱਥੋਂ ਦੇ ਹੋਰ ਇਤਿਹਾਸਿਕ ਚੀਜ਼ਾਂ ਬਾਰੇ ਪਤਾ ਲੱਗਦਾ ਹੈ ਜੋ ਕਿ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਅਲੱਗ ਅਲੱਗ ਹੁੰਦੀ ਹੈ ਅਤੇ ਉੱਧਰ ਦੇਖਣ ਨੂੰ ਨਹੀਂ ਮਿਲਦੀ ਜਿਵੇਂ ਕਿ ਸ਼ਿਮਲਾ ਅਤੇ ਮਨਸੂਰੀ ਇਹਨਾਂ ਵਿੱਚ ਬਰਫ ਅਤੇ ਠੰਡ ਬਹੁਤ ਜ਼ਿਆਦਾ ਪੈਂਦੀ ਹੈ ਜਿਹੜੀ ਕਿ ਭਾਰਤ ਦੇ ਹੋਰ ਰਾਜ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਰਾਜਸਥਾਨ ਵਿੱਚ ਗਰਮੀ ਜ਼ਿਆਦਾ ਹੁੰਦੀ ਹੈ ਅਤੇ ਉੱਥੇ ਰੇਤਲਾ ਰੇਤ ਜ਼ਿਆਦਾ ਮਿਲਦੀ ਹੈ ਅਤੇ ਉਹ ਹੋਰ ਸਥਾਨਾਂ 'ਤੇ ਬਹੁਤ ਘੱਟ ਹੁੰਦੀ ਹੈ ਭਾਰਤ ਦਾ ਇੱਕ ਰਾਜ ਹੈ ਅੰਮ੍ਰਿਤਸਰ ਉੱਥੇ ਸਾਨੂੰ ਗੋਲਡਨ ਟੈਂਪਲ ਅਤੇ ਜਲ੍ਹਿਆਂ ਵਾਲਾ ਬਾਗ ਅਤੇ ਉਹਦੇ ਨਜ਼ਦੀਕ ਹੀ ਵਾਘਾ ਬਾਰਡਰ ਹੈ ਅਤੇ ਇਹੋ ਜਿਹੀਆਂ ਚੀਜ਼ਾਂ ਸਾਨੂੰ ਦੇਖਣ ਲਈ ਜ਼ਰੂਰ ਜਾਣਾ ਚਾਹੀਦਾ ਹੈ